ਮੈਂ ਤੁਹਾਨੂੰ ਇੱਕ ਭੰਗੜਾ ਐਰੋਬਿਕਸ ਰੂਟੀਨ ਬਾਰੇ ਦੱਸਣਾ ਚਾਹੁੰਦਾ ਹਾਂ ਜਿਹਦੇ ਵਿੱਚ ਮੈਂ ਤੁਹਾਨੂੰ ਗੱਲ ਕਰਨੀ ਚਾਹੁੰਦਾ ਹਾਂ ਹਾਈ ਇੰਟੈਸਟੀ ਭੰਗੜੇ ਦੀ ਜੋ ਕਿ ਆਪਣੇ ਕਲਚਰ ਨਾਲ ਹੀ ਜੁੜਿਆ ਹੋਇਆ ਹੈ ਜੋ ਕਿ ਆਪਣੇ ਸੱਭਿਆਚਾਰ ਨਾਲ ਹੀ ਜੁੜਿਆ ਹੋਇਆ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਆਪਣੇ ਭੰਗੜੇ ਦੇ ਵਿੱਚ ਬਹੁਤ ਸਾਰੀਆਂ ਫੋ ਇੱਕ ਫੋਰਮਸ ਹੁੰਦੀਆਂ ਨੇ ਜ ਜਾਨੀ ਕਿ ਭੰਗੜੇ ਪਾਉਣ ਦੇ ਬਹੁਤ ਸਾਰੇ ਤਰੀਕੇ ਹੁੰਦੇ ਨੇ ਅਤੇ ਮੈਨੂੰ ਸਭ ਤੋਂ ਵਧੀਆ ਭੰਗੜੇ 'ਚ ਲੱਗਦੀ ਹੈ ਪੜਤਾਲ ਜਾਂ ਘੋੜ ਚਾਲ ਜਾਂ ਲ ਫਸਲਾਂ ਵਾਲਾ ਮੈਨੂੰ ਸਟੈਪ ਸਭ ਤੋਂ ਵਧੀਆ ਲੱਗਦਾ ਹੈ ਜਾਨੀ ਕਿ ਇਹ ਇਹ ਮੈਨੂੰ ਸਭ ਤੋਂ ਵਧੀਆ ਇਸ ਕਰਕੇ ਲੱਗਦਾ ਹੈ ਕਿਉਂਕਿ ਇਹ ਆਪਣੇ ਕਲਚਰ ਨਾਲ ਸਭ ਤੋਂ ਜ਼ਿਆਦਾ ਜੁੜਿਆ ਹੋਇਆ ਹੈ ਜਾਨੀ ਕਿ ਇਹ ਮੈਂ ਤਾਂ ਕਰਕੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਇਸ ਇਸ ਬਾਰੇ ਬਹੁਤ ਕੁਝ ਜਾਣਦਾ ਹਾਂ ਕਿਉਂਕਿ ਮੈਂ ਕਾਲਜ ਦੇ ਵਿੱਚ ਪੜ੍ਹਦਾ ਹੁੰਦਾ ਸਾਂ ਅਤੇ ਮੇਰੇ ਨਾਲ ਮੇਰੇ ਹੋਰ ਵੀ ਸਾਥੀ ਇੰਟਰਵਸਟੀ ਕੋਂਪੀਟੀਸ਼ਨ ਤੱਕ ਗਏ ਹਾਂ ਅਸੀਂ ਅਤੇ ਉੱਥੇ ਵੀ ਬਹੁਤ ਸਾਰੇ ਭੰਗੜਚੀ ਮੇਰੇ ਨਾਲ ਦੇ ਬਹੁਤ ਸੋਹਣਾ ਸੋਹਣਾ ਭੰਗੜਾ ਕਰਦੇ ਸਨ ਅਤੇ ਮੈਂ ਇਸ ਬਾਰੇ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਧੰਨਵਾਦ ਜੀ